ਭਾਰਤ ਦੇਸ਼ ਇੱਕ ਕਲਾ ਸ਼ੈਲੀਆਂ ਦੇ ਨਾਲ ਭਰਪੂਰ ਦੇਸ਼ ਹੈ ਪੁਰਾਣੇ ਸਮੇਂ ਦੇ ਵਿੱਚ ਸਾਰੇ ਬਜ਼ੁਰਗ ਜਾਂ ਫਿਰ ਪੁਰਾਣੇ ਵੇਲੇ ਦੇ ਜਿਹੜੇ ਲੋਕ ਸੀਗੇ ਉਹ ਇਕੱਠੇ ਬਹਿ ਕੇ ਚਾਦਰਾਂ ਕੱਢਦੇ ਸੂਟਾਂ 'ਤੇ ਕਢਾਈ ਕਰਦੇ ਫੁਲਕਾਰੀਆਂ ਕੱਢਦੇ ਪਰਾਂਦੇ ਬੁਣਦੇ ਨਾਲੇ ਬੁਣਦੇ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਕਲਾ ਸ਼ੈਲੀਆਂ ਨੇ ਉਹ ਕਰਦੇ ਸਨ ਪਰ ਜਿਵੇਂ ਜਿਵੇਂ ਭਾਰਤ ਦੇਸ਼ ਵਿਕਸਿਤ ਹੁੰਦਾ ਜਾ ਰਿਹਾ ਹੈ ਉਵੇਂ ਉਵੇਂ ਇਹ ਕਲਾ ਸ਼ੈਲੀਆਂ ਜਿਹੜੀਆਂ ਨੇ ਪਿੱਛੇ ਛੁੱਟਦੀਆਂ ਜਾ ਰਹੀਆਂ ਹਨ ਸਕੂਲਾਂ ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਵਿੱਚ ਇਹਨਾਂ ਨੂੰ ਚਲਾਉਣ ਦੀ ਲੋੜ ਹੈ ਇਹਨਾਂ ਨੂੰ ਲੋਕਾਂ ਨੂੰ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਕਿਵੇਂ ਕਲਾ ਸ਼ੈਲੀਆਂ ਜਿਵੇਂ ਕਿ ਨਾਲਾ ਬੁਣਾਈ ਕਿਵੇਂ ਕੀਤੀ ਜਾਂਦੀ ਹੈ ਪੀੜੀਆਂ ਮੰਜੇ ਕਿਵੇਂ ਉਣੇ ਜਾਂਦੇ ਨੇ ਅਤੇ ਪਰਾਂਦੇ ਕਿਵੇਂ ਉਣੇ ਜਾਂਦੇ ਨੇ ਫੁਲਕਾਰੀਆਂ 'ਤੇ ਕਢਾਈ ਕਿਵੇਂ ਕੀਤੀ ਜਾਂਦੀ ਹੈ ਚਾਦਰਾਂ ਕਿਵੇਂ ਕੱਢੀਆਂ ਜਾਂਦੀਆਂ ਨੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਜਿਵੇਂ ਚਰਖਾ ਕੱਤਣਾ ਰੂੰ ਕਿੱਦਾਂ ਪਿੰਜਿਆ ਜਾਂਦਾ ਹੈ ਕਈ ਤਰ੍ਹਾਂ ਦੀਆਂ ਕਲਾ ਸ਼ੈਲੀਆਂ ਨੇ ਜਿਹੜੀ ਕਿ ਲੋੜ ਹੈ ਬੱਚਿਆਂ ਨੂੰ ਸਿਖਾਉਣ ਦੀ ਤਾਂ ਕਿ ਇਹ ਸੱਭਿਆਚਾਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਚ ਸਕਣ ਸੱਭਿਆਚਾਰ ਇੱਕ ਬਹੁਤ ਹੀ ਅਨਮੋਲ ਗਹਿਣਾ ਮੰਨਿਆ ਜਾਂਦਾ ਹੈ ਅਤੇ ਕਲਾ ਸ਼ੈਲੀਆਂ ਵੀ ਸੱਭਿਆਚਾਰ ਦਾ ਇੱਕ ਹਿੱਸਾ ਹੁੰਦੀਆਂ ਨੇ ਜੇ ਕਲਾ ਸ਼ੈਲੀਆਂ ਹੀ ਨਾ ਰਹੀਆਂ ਤਾਂ ਲੋਕਾਂ ਦੇ ਹੱਥਾਂ ਦੇ ਵਿੱਚ ਗੁਣ ਨਾ ਰਹੇਗਾ ਤਾਂ ਜੋ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਕਿਹੜੀਆਂ ਕਿਹੜੀਆਂ ਕਲਾ ਸ਼ੈਲੀਆਂ ਨੇ ਜਿਨ੍ਹਾਂ ਨੂੰ ਅਪਣਾਇਆ ਜਾਵੇ ਅਤੇ ਅੱਗੇ ਬੱਚਿਆਂ ਨੂੰ ਵੀ ਸਿਖਾਇਆ ਜਾਵੇ